ਸੱਤ ਲੱਖ ਦਸ ਹਜ਼ਾਰ ਅੱਠ ਸੌ ਤੇਈ ਨੌਂ ਲੱਖ ਵੀਹ ਹਜ਼ਾਰ ਸੱਤ ਸੌ ਬੱਤੀ ਛੇ ਲੱਖ ਉਨਾਸੀ ਹਜ਼ਾਰ ਅੱਠ ਸੌ ਸੱਠ ਪੰਜ ਲੱਖ ਅੱਸੀ ਹਜ਼ਾਰ ਨੌਂ ਸੌ ਬੱਤੀ ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਨੜਿਨਵੇਂ